ਹਾਂ ਮੈਂ ਆਪਣੇ ਪਹਿਲੇ ਡਰਾਇੰਗ ਅਨੁਭਵ ਦਾ ਵਰਣਨ ਕਰ ਸਕਦੀ ਹਾਂ ਕਿ ਡਰਾਇੰਗ ਸ਼ੁਰੂ ਕਰਨ ਲਈ ਮੈਨੂੰ ਕਿਸ ਚੀਜ਼ ਨੇ ਪ੍ਰੇਰਿਤ ਕੀਤਾ ਸੀ ਸਭ ਤੋਂ ਪਹਿਲਾਂ ਮੈਨੂੰ ਡਰਾਇੰਗ ਨੂੰ ਸ਼ੁਰੂ ਕਰਨ ਲਈ ਮੇਰੀ ਅਧਿਆਪਕ ਨੇ ਪ੍ਰੇਰਿਤ ਕੀਤਾ ਸੀ ਜਿਹਨਾਂ ਦਾ ਨਾਮ ਸੀ ਸ਼ੋਭਾ ਕੁਮਾਰੀ ਉਸ ਸਮੇਂ ਮੈਂ ਐਲਕੇਜੀ ਦੀ ਜਮਾਤ ਵਿੱਚ ਹੁੰਦੀ ਸੀ ਮੇਰੇ ਅਧਿਆਪਕ ਜੀ ਨੇ ਮੈਨੂੰ ਇੱਕ ਅੰਬ ਦੀ ਤਸਵੀਰ ਬਣਾਉਣ ਲਈ ਕਿਹਾ ਅਤੇ ਮੈਨੂੰ ਉਹ ਅੰਬ ਦੀ ਤਸਵੀਰ ਨਹੀਂ ਸੀ ਬਣਾਉਣੀ ਆਉਂਦੀ ਉਹਨਾਂ ਨੇ ਮੈਨੂੰ ਉਹ ਤਸਵੀਰ ਬਣਾਉਣ ਲਈ ਕਿੰਨੇ ਦਿਨਾਂ ਤੱਕ ਅਭਿਆਸ ਕਰਾਇਆ ਅਤੇ ਮੇਰੀ ਸਹਾਇਤਾ ਕਰਦੇ ਰਹੇ ਉਹਨਾਂ ਨੇ ਮੇਰੇ ਨਾਲ ਮੈਨੂੰ ਹੱਥ ਫੜ ਕੇ ਤਸਵੀਰ ਬਣਾਉਣਾ ਸਿਖਾਇਆ ਅਤੇ ਮੈਂ ਉਹ ਤਸਵੀਰ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ ਪਹਿਲਾਂ ਤਾਂ ਮੈਂ ਸਿਰਫ ਅੰਬ ਦੀ ਹੀ ਤਸਵੀਰ ਬਣਾਈ ਸੀ ਹੌਲੀ ਹੌਲੀ ਮੈਂ ਜਿਵੇਂ ਕਿ ਘਰ ਸੇਬ ਇਹ ਸਭ ਦੀ ਤਸਵੀਰ ਬਣਾਉਣ ਲੱਗ ਗਈ ਮੈਨੂੰ ਅੱਜ ਵੀ ਯਾਦ ਹੈ ਮੈਂ ਆਪਣੇ ਅਧਿਆਪਕ ਜੀ ਦਾ ਸ਼ੁਕਰੀਆ ਕਰਦੀ ਹਾਂ ਜਿਹਨਾਂ ਨੇ ਮੈਨੂੰ ਡਰਾਇੰਗ ਕਰਨੀ ਸਿਖਾਏ ਉਹਨਾਂ ਨੇ ਹੀ ਮੈਨੂੰ ਅੱਜ ਇਸ ਮੁਕਾਮ ਤੱਕ ਸ਼ਾਇਦ ਪਹੁੰਚਾਇਆ ਹੋ ਸਕਦਾ ਹੈ ਉਹਨਾਂ ਨੇ ਹੀ ਮੈਨੂੰ ਤਸਵੀਰਾਂ ਬਣਾਉਣੀਆਂ ਸਿਖਾਈਆਂ ਸੀ ਅੱਜ ਮੈਂ ਇਸ ਮੁਕਾਮ 'ਤੇ ਹਾਂ ਕਿ ਮੈਂ ਕੋਈ ਵੀ ਤਸਵੀਰਾਂ ਬਣਾ ਲੈਂਦੀ ਹਾਂ ਜਿਵੇਂ ਕਿ ਕਿਸੇ ਇਨਸਾਨ ਨੂੰ ਦੇਖ ਕੇ ਅਗਰ ਮੈਨੂੰ ਕੋਈ ਚੀਜ਼ ਚੰਗੀ ਲੱਗਦੀ ਹੈ ਫੁੱਲ ਦੇਖ ਲਵਾਂ ਆਸਮਾਨ ਕੋਈ ਘਰ ਦੇਖ ਲਵਾਂ ਕੋਈ ਗੱਡੀ ਦੇਖ ਲਵਾਂ ਤਾਂ ਮੈਨੂੰ ਵਧੀਆ ਲੱਗਦਾ ਹੈ ਅਤੇ ਮੈਂ ਉਹ ਤਸਵੀਰਾਂ ਬਣਾਉਣ ਲੱਗ ਜਾਂਦੀ ਹਾਂ ਲੋਕ ਮੇਰੀਆਂ ਤਸਵੀਰਾਂ ਨੂੰ ਪਸੰਦ ਵੀ ਕਰਦੇ ਹਨ ਅਤੇ ਮੈਂ ਛੋਟੇ ਛੋਟੇ ਬੱਚਿਆਂ ਨੂੰ ਤਸਵੀਰਾਂ ਵੀ ਬਣਾਉਣੀਆਂ ਸਿਖਾਉਂਦੀ ਹਾਂ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਕਿ ਬੱਚਿਆਂ ਨੂੰ ਤਸਵੀਰਾਂ ਸਿਖਾਉਣੀਆਂ ਇਸ ਨਾਲ ਸਾਨੂੰ ਕਾਫੀ ਚੀਜ਼ਾਂ ਦਾ ਗਿਆਨ ਮਿਲਦਾ ਹੈ ਤਸਵੀਰਾਂ ਬਣਾਉਣ ਨਾਲ ਆਪਣਾ ਹੱਥ ਚੰਗਾ ਰਹਿੰਦਾ ਹੈ ਸਾਨੂੰ ਕੰਮ ਕਰਨ ਦੀ ਆਦਤ ਰਹਿੰਦੀ ਹੈ ਅਤੇ ਆਪਾਂ ਇੱਕ ਵਧੀਆ ਆਰਟਿਸਟ ਬਣ ਸਕਦੇ ਹਾਂ ਅਤੇ ਮੈਂ ਅੱਜ ਵਧੀਆ ਹੀ ਆਰਟਿਸਟ ਹਾਂ ਮੈਂ ਡਰਾਇੰਗਾਂ ਬਣਾਉਂਦੀ ਹਾਂ